ਹੈਲੋ ਹਾਂਜੀ ਆਰੀਅਨ ਭਾਅ ਜੀ ਕੀ ਹਾਲ ਆ ਬਸ ਵਧੀਆ ਭਾਅ ਜੀ ਤੁਸੀਂ ਯਾਦ ਨਹੀਂ ਕਰਦੇ ਹੁਣ ਜਦੋਂ ਦੀ ਪਲੱਸ ਟੂ ਹੋਈ ਆ ਪਤਾ ਕੀ ਭਰਾ ਤੂੰ ਫੋਨ ਹੀ ਨਹੀਂ ਕਰਦਾ ਪਲੱਸ ਟੂ ਹੋ ਗਈ ਤੇਰੀ ਤੂੰ ਭੁੱਲ ਹੀ ਗਿਆ ਸਾਨੂੰ ਹਾਂ ਕੀ ਸੋਚਿਆ ਫਿਰ ਪਲੱਸ ਟੂ ਮੈਡੀਕਲ 'ਚ ਕੀਤੀ ਆ ਆਪਾਂ ਦੋਨਾਂ ਨੇ ਫਿਰ ਹੁਣ ਕੀ ਕਰੀਏ ਅੱਗੇ ਫਿਰ ਪੁੱਛਣਾ ਕੀ ਹੈ ਕੋਈ ਮੈਡੀਕਲ ਕੋਲਜ ਲੈਂਦੇ ਹਾਂ ਐਡਮਿਸ਼ਨ ਅਤੇ ਉੱਥੇ ਕਰਦੇ ਹਾਂ ਅੱਗੇ ਡਾਕਟਰੀ ਦਾ ਕੋਰਸ ਕਰਦੇ ਹਾਂ ਆਹ ਸੋਚਿਆ ਹੈ ਵਧੀਆ ਸਗੋਂ ਡਾਕਟਰੀ 'ਚ ਤੈਨੂੰ ਪਤਾ ਬੜਾ ਫਾਇਦਾ ਹੈਗਾ ਡਾਕਟਰ ਬਣ ਜਾਂਦੇ ਹਾਂ ਆਪਾਂ ਦੋਨੇ ਜਾਣੇ ਆਹੋ ਔਰ ਯਾਦ ਯੂਦ ਕਰਦਾ ਰਿਹਾ ਕਰ ਆਹੋ ਹੋਰ ਤੇਰੇ ਯਾਰ ਦੋਸਤ ਨੇ ਮੈਡੀਕਲ ਕੀਤਾ ਉਹਨੇ ਕੀ ਕਰਨਾ ਪਠਾਨਕੋਟ 'ਚ ਖੁੱਲ੍ਹੇ ਪਠਾਨਕੋਟ 'ਚ ਖੁੱਲ੍ਹੇ ਹੈਗੇ ਦੋ ਤਿੰਨ ਕੋਲਜ ਉੱਥੇ ਲੈ ਲਈਏ ਐਡਮਿਸ਼ਨ ਉੱਥੇ ਕਰਦੇ ਆਪਾਂ ਦੋਨੋਂ ਜਾਣੇ ਚਲ ਜਾਂਦੇ ਹਾਂ ਬਾਕੀ ਗੋਲੀ ਮਾਰ